ਹਾਂਜੀ ਰਮਨ ਜੀ ਤੁਹਾਨੂੰ ਮੈਂ ਇੱਕ ਆਡਰ ਦਿੱਤਾ ਸੀਗਾ ਸ਼ਾਹੀ ਪਨੀਰ ਦਾ ਪੀਜ਼ਾ ਦਾ ਹਜੇ ਤੱਕ ਪਹੁੰਚਿਆ ਨਹੀਂ ਵੀਹ ਮਿੰਨਟ ਹੋ ਗਏ ਤੁਸੀਂ ਤਾਂ ਪੰਦਰਾਂ ਮਿੰਟ ਕਿਹਾ ਤਾ ਡਿਲੀਵਰੀ ਕਰਨੀ ਹੈ ਕਿੰਨਾ ਟਾਇਮ ਹੋਰ ਲੱਗਣਾ ਅਸੀਂ ਵਿਹਲੇ ਬੈਠੇ ਉਰੇ ਬੰਦਾ ਤੇਰਾ ਟਰੈਫ਼ਿਕ 'ਚ ਫਸ ਗਿਆ ਮੇਰੀ ਜ਼ਿੰਮੇਦਾਰੀ ਹੈ ਅਤੇ ਤੁਸੀਂ ਇਹ ਲਿਖ ਕੇ ਕਿਉਂ ਦਿੱਤਾ ਹੋਇਆ ਕਿ ਪੰਦਰਾਂ ਮਿੰਟ ਦੇ ਅੰਦਰ ਅੰਦਰ ਸਮਾਨ ਪਹੁੰਚਣਾ ਹੁਣ ਤੱਕ ਪੱਚੀ ਮਿੰਟ ਹੋ ਚੁੱਕੇ ਹੈ ਦੱਸ ਮਿੰਟ ਉਪਰ ਹੋ ਗਿਆ ਬੰਦਾ ਮੇਰੇ ਕੋਲ ਆ ਗਿਆ ਤੁਹਾਨੂੰ ਉਹਦਾ ਕੋਈ ਵੀ ਪੈਸਾ ਨਹੀਂ ਮਿਲਣਾ ਠੀਕ ਹੈ ਓਕੇ